ਪੰਜਾਬ ਵਿੱਚ ਕਾਰੋਬਾਰ ਲਈ ਮੁੱਖ ਮੌਕੇ ਬਹੁਤ ਹਨ ਜਿਵੇਂ ਕਿ ਡਿਟਰਜੈਂਟ ਪਾਊਡਰ ਮੈਨੀਫੈਕਚਰਿੰਗ ਕੰਪਨੀ ਮੈਨੂੰਫੈਕਚਰ ਹੁੰਦਾ ਡਿਟਰਜੈਂਟ ਪਾਊਡਰ ਆ ਜਿਹੜਾ ਕੱਪੜਿਆਂ ਨੂੰ ਧੋਣ ਦੇ ਲਈ ਪਾਊਡਰ ਵਰਤਿਆ ਜਾਂਦਾ ਸਰਫ ਵਰਤਿਆ ਜਾਂਦਾ ਉਹਨੂੰ ਉਹਨੂੰ ਬਣਾਉਣਾ ਬਣਾਉਣ ਤੋਂ ਬਾਅਦ ਫਿਰ ਆਪਣਾ ਉਹਨੂੰ ਕਾਰੋਬਾਰ ਵਧਾਉਣ ਦੇ ਲਈ ਆਪਣਾ ਮਸ਼ਹੂਰ ਮਸ਼ਹੂਰੀ ਕੀਤੇ ਜਾਵੇ ਉਸ ਦੀ ਅਤੇ ਜਿਵੇਂ ਲਾ ਲਓ ਲੈਦਰ ਗੌਰਮੈਂਟਸ ਮੇਕਿੰਗ ਆ ਹੁਣ ਜਿਹੜੇ ਲੈਦਰ ਦੇ ਕੱਪੜੇ ਬਣਦੇ ਨੇ ਠੀਕ ਹੈ ਉਹਨੂੰ ਕਾਰੋਬਾਰ ਵਧਾਉਣ ਦੇ ਲਈ ਐਡ ਕੀਤੀ ਜਾਵੇ ਵੱਧ ਤੋਂ ਵੱਧ ਮਸ਼ਹੂਰੀ ਕੀਤੀ ਜਾਵੇ ਠੀਕ ਏ ਅਤੇ ਫਰੂਟ ਵੈਜੀਟੇਬਲ ਐਕਸਪੋਰਟ ਠੀਕ ਹੈ ਫੂਡ ਵੈਜੀਟੇਬਲ ਨੇ ਜਿਹੜੇ ਫਲ ਅਤੇ ਸਬਜ਼ੀਆਂ ਨੇ ਉਹ ਐਕਸਪੋਰਟ ਵੀ ਕਰੀਆਂ ਜਾਣ ਠੀਕ ਏ ਨਾ ਵੱਧ ਤੋਂ ਵੱਧ ਆਪਣਾ ਪੈਸਾ ਕਮਾਇਆ ਜਾਵੇ ਔਰ ਜਿਹੜੀਆਂ ਮੰਡੀਆਂ ਦੇ ਵਿੱਚ ਵੱਧ ਸ ਆਪਣਾ ਸੇਲ ਹੁੰਦੀ ਆ ਉਸ ਆਪਣਾ ਉਹਨਾਂ ਮੰਡੀਆਂ 'ਚ ਜਾ ਕੇ ਉਹਨਾਂ ਦੇਸ਼ਾਂ 'ਚ ਜਾ ਕੇ ਆਪਣਾ ਕੀ ਏ ਵੱਧ ਤੋਂ ਵੱਧ ਫਰੂਟ ਐਕਸਪੋਰਟ ਕੀਤਾ ਜਾਵੇ ਆਪਣਾ ਫਲ ਅਤੇ ਸਬਜ਼ੀਆਂ ਐਕਸਪੋਰਟ ਕੀਤੀਆਂ ਜਾਣ